ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮ ਹਾਂਜੀ ਹਾਂ ਅੱਛਾ ਮੈਮ ਕਦੋਂ ਹੈ ਮੈਮ ਸੌਰੀ ਮੈਮ ਬਟ ਮੈਂ ਤਾਂ ਅੱਜ ਬੀਜੀ ਹਾਂ ਹਾਂ ਹਾਂਜੀ ਮੈਮ ਤੁਸੀਂ ਮੈਨੂੰ ਇੱਦਾਂ ਹੀ ਦੱਸ ਦੋ ਰਿਜਲਟ ਕਿਆ ਹੈ ਹਾਂਜੀ ਮੈਮ ਅੱਛਾ ਮੈਮ ਹਾਂਜੀ ਮੈਮ ਠੀਕ ਹੈ ਮੈਮ ਮੈਮ ਬਾਕੀ ਸਬਜੈਕਟਾਂ ਵਿੱਚ ਠੀਕ ਹੈ ਇਹ ਹਾਂਜੀ ਉਹ ਤਾਂ ਮੈਮ ਘਰ ਤੋਂ ਹੀ ਛੇਤੀ ਨਿੱਕਲ ਜਾਂਦਾ ਹੈ ਪੁੱਜਦਾ ਨਹੀਂ ਉਹ ਕੋਲਿਜ ਨਹੀਂ ਨਹੀਂ ਮੈਮ ਉਹਨੂੰ ਤਾਂ ਅਸੀਂ ਸਵੇਰੇ ਸਾਜਰੇ ਤਿਆਰ ਕਰਕੇ ਟਾਈਮ ਨਾਲ ਭੇਜ ਦਿੰਦੇ ਹਾਂ ਕੋਈ ਨਹੀਂ ਮੈਮ ਉਹਨੂੰ ਉਹ ਦੀ ਤਾਂ ਮੈਂ ਕਲਾਸ ਲਾਉਂਦੀ ਹਾਂ ਜਦ ਵੀ ਉਹ ਘਰ ਆਉਂਗਾ ਬਾਕੀ ਮੈਮ ਤੁਸੀਂ ਮਾੜਾ ਜਿਹਾ ਉਹ 'ਤੇ ਧਿਆਨ ਦਿਓ ਉਹਦੀਆਂ ਕੋਈ ਵੀ ਉਹਦੇ ਚੰਗੀ ਤਰ੍ਹਾਂ ਉਹਨੂੰ ਖਿੱਚ ਕੇ ਰੱਖਿਆ ਕਰੋ ਜੇ ਕਿਤੇ ਪੜ੍ਹਦਾ ਨਹੀਂ ਉਹਦੀ ਕੁਟਾਈ ਕਰੋ ਤੁਸੀਂ ਬਾਕੀ ਜੇ ਉਹ ਸ਼ਰਾਰਤਾਂ ਕਰਦਾ ਕਲਾਸ 'ਚ ਤੁਸੀਂ ਮੈਨੂੰ ਜਦੇ ਕੋਲ ਕਰਕੇ ਦੱਸ ਦਿਆ ਕਰੋ ਹੁਣ ਮੈਮ ਅਸੀਂ ਤਾਂ ਧਿਆਨ ਤਾਂ ਦਿੰਦੇ ਹੀ ਹਾਂ ਬਟ ਜਦੋਂ ਹੁਣ ਉਹਦੇ ਦਿਮਾਗ 'ਚ ਜਦ ਕੁਛ ਵੜਦਾ ਨਹੀਂ ਤਾਂ ਕਿਆ ਕਰ ਸਕਦੇ ਹਾਂ ਅਸੀਂ ਬਾਕੀ ਅਸੀਂ ਆਪਣੇ ਵੱਲੋਂ ਤਾਂ ਪੂਰਾ ਧਿਆਨ ਦਉਂਗੇ ਅੱਗੇ ਤੋਂ ਦਿਓ ਧਿਆਨ ਮੈਮ ਥੋੜ੍ਹਾ ਜਿਹਾ ਠੀਕ ਹੈ ਮੈਮ ਓਕੇ ਮੈਮ ਠੀਕ ਹੈ ਮੈਮ ਓਕੇ ਮੈਮ ਸਤਿ ਸ਼੍ਰੀ ਕਾ